ਮੈਂ ਮੰਦਰਾਂ ਵਿੱਚ ਜਾਨਾ ਏ ਜੀ ਜਦੋਂ ਮੰਦਰਾਂ ਵਿੱਚ ਜਾਨਾ ਏ ਜੀ ਮੈਂ ਅਤੇ ਬਹੁਤ ਵਧੀਆ ਸਜਾਵਟ ਕਰੀ ਵੀ ਹੁੰਦੀ ਆ ਰੰਗੋਲੀ ਬਣਾਈ ਵੀ ਹੁੰਦੀ ਆ ਜੀ ਅਤੇ ਜਦ ਮੈਂ ਮੱਥਾ ਟੇਕਦਾ ਇਹ ਮੱਥਾ ਟੇਕਦੇ ਹਾਂ ਪ੍ਰਸ਼ਾਦ ਬਹੁਤ ਵਧੀਆ ਤਰੀਕੇ ਨਾਲ਼ ਦਿੰਦੇ ਆ ਜੀ ਵਧੀਆ ਦਿੰਦੇ ਜੀ ਪ੍ਰਸ਼ਾਦ ਜੀ ਇਹ ਅਤੇ ਇਹ ਇੱਕ ਹੋਰ ਇਹਨਾਂ 'ਚ ਉਹ ਆ ਜੀ ਇਹ ਚੰਦਨ ਦਾ ਟਿੱਕਾ ਲਾਉਂਦੇ ਆ ਜੀ ਬਹੁਤ ਵਧੀਆ ਸਕੂਨ ਮਿਲਦਾ ਸੀ ਮੱਥਾ ਟੇਕਣ ਨੂੰ ਬਹੁਤ ਵਧੀਆ ਲੱਗਦਾ ਜੀ ਜੇ ਮੈਂ ਦਰਾਹਾਂ ਦਰਗਾਹਾਂ ਪਰ ਵੀ ਜਾਨਾ ਜੀ ਚਲੋ ਮੱਥਾ ਟੇਕਣ ਮੈਨੂੰ ਬਹੁਤ ਵਧੀਆ ਲੱਗਦਾ ਜੀ ਸੁੱਖਾਂ ਬਾਹਰ ਆਉਦੀਆਂ ਏ ਜੀ ਪੀਰਾਂ ਦੇ ਜਾਨਾਂ ਏ ਜੀ ਮੈਂ ਮੱਥਾ ਟੇਕਦਾ ਸਾਰੇ ਪਾਸੇ ਘੁੰਮੀ ਦਾ ਆਪਾਂ ਐਂ ਨਹੀਂ ਕਹਿੰਦੇ ਵੀ ਹਾਂ ਇੱਕੋ ਧਰਮ ਦੇ ਮੱਥਾ ਸਾਰੇ ਪਾਸੇ ਟੇਕੋ ਜੀ ਮੈਂ ਗੁਰਦੁਆਰਾ ਸਾਹਿਬ ਵੀ ਜਾਨਾ ਜੀ ਗੁਰਦੁਆਰਾ ਸਾਹਿਬ ਵੀ ਜਾਈਦਾ ਮੱਥਾ ਟੇਕੀਦਾ ਜੀ ਬੈਠੀਦਾ ਪਾਠ ਸੁਣੀਦਾ ਜੀ ਬਾਬੇ ਦਾ ਨੋਂ ਜਪੀ ਦਾ ਐਨ ਗਰੂਆਂ ਦਾ ਸਾਹਿਬਜ਼ਾਦਿਆਂ ਦਾ ਨੋਂ ਜਪੀਦਾ ਜੀ ਸਤਿਨਾਮ ਵਾਹਿਗੁਰੂ ਕਰੀਦਾ ਜੀ ਐਨ ਵਧੀਆ ਉਹਦੇ ਨਾਲ਼ ਕਰੀਦਾ ਜੀ ਐਂ ਨਹੀਂ ਵੀ ਮਨ ਨੂੰ ਸ਼ਾਂਤੀ ਆਉਂਦੀ ਹੈ ਜੀ ਸ਼ਾਂਤ ਐਨ ਸ਼ਾਂਤ ਹੋ ਕੇ ਬੈਠੀਦਾ ਜੀ ਪੂਰਾ ਐਨ ਜੀ ਐਂ ਨਹੀਂ ਕਹਿਣਾ ਵੀ ਆਪਾਂ ਹੋਰ ਪਾਸੇ ਧਿਆਨ ਦੇਣਾ ਏ ਜੀ ਆਪਾਂ ਹੋਰ ਪਾਸੇ ਕਿਤੇ ਧਿਆਨ ਨਹੀਂ ਦਿੰਦੇ ਜਦ ਆਪਾਂ ਗੁਰੂ ਕਨੀ ਨੂੰ ਜਾਣਾ ਜਾਂ ਮੰਦਰ 'ਚ ਜਾਣਾ ਜਾਂ ਕਿਸੇ ਪੀਰ 'ਤੇ ਜਾਣਾ ਐਨ ਸੱਚੇ ਮਨ ਨਾਲ਼ ਆਪਾਂ ਉਹ ਕਰਦੇ ਹਾਂ ਜੀ ਐਂ ਨਹੀਂ ਹੈਗਾ ਵੀ ਆਪਾਂ ਗੱਲਾਂ ਕਨੀ ਧਿਆਨ ਦੇ ਲਿਆ ਲੋਕਾਂ ਵਾਂਗ ਗੱਲਾਂ ਮਾਰੀ ਜਾਣੀਆਂ ਨਾ ਜੀ ਆਪਾਂ ਗੱਲਾਂ ਕਦੇ ਨਹੀਂ ਮਾਰਦੇ